ਨਮਸਕਾਰ ਜੀ ਮੈਂ ਸ਼ਾਮ ਲਾਲ ਫਾਜ਼ਿਲਕਾ ਤੋਂ ਗੱਲ ਕਰ ਰਿਹਾ ਹਾਂ ਮੇਰੇ ਆਟੋ ਰਿਕਸ਼ਾ ਦੀ ਤੰਦਰੁਸਤੀ ਸਰਟੀਫਿਕੇਟ ਦੀ ਮਿਆਦ ਅਗਲੇ ਮਹੀਨੇ ਖਤਮ ਹੋ ਰਹੀ ਹੈ ਮੈਂ ਇਸ ਨੂੰ ਨਵਿਆਉਣਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਇਸ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਇਸ ਲਈ ਲੋੜੀਂਦੇ ਕਾਗਜ਼ਾਤ ਜੋ ਕਿ ਜ਼ਰੂਰੀ ਹਨ ਵੀ ਮੈਨੂੰ ਦੱਸੇ ਜਾਣ ਤਾਂ ਜੋ ਮੈਂ ਜਲਦੀ ਤੋਂ ਜਲਦੀ ਇਸ ਪ੍ਰਕਿਰਿਆ ਨੂੰ ਪੂਰਾ ਕਰ ਸਕਾਂ